ਨਮਸਕਾਰ ਮੇਰਾ ਨਾਮ ਸਾਕਸ਼ੀ ਹੈ ਅਤੇ ਮੈਂ ਪਠਾਨਕੋਟ ਜਿਲ੍ਹੇ ਦੀ ਰਹਿਣ ਵਾਲੀ ਹਾਂ ਜਿਵੇਂ ਕਿ ਸਾਡੇ ਭਾਰਤ ਦੇਸ਼ ਨੇ ਕਾਫੀ ਜ਼ਿਆਦਾ ਤਰੱਕੀ ਕੀਤੀ ਹੈ ਅਤੇ ਉਸ ਨੇ ਕਾਫੀ ਸਾਰੀਆਂ ਨਵੀਆਂ ਨਵੀਆਂ ਖੋਜਾਂ ਕਾਢਾਂ ਕੱਢੀਆਂ ਹਨ ਉਸ ਨੇ ਇਹ ਵੀ ਪਤਾ ਲਗਾਇਆ ਹੈ ਕਿ ਸਾਡਾ ਸਪੇਸ ਵਿੱਚ ਜੀਵਨ ਪੋਸੀਬਲ ਹੈ ਐ ਪਰ ਹਜੇ ਉਸ ਨੇ ਇਹ ਪ੍ਰੋਪਰ ਨਹੀਂ ਦੱਸਿਆ ਕਿ ਅਸੀਂ ਕਿਹੜੇ ਕਿਹੜੇ ਗ੍ਰਹਿ 'ਤੇ ਸਾਡਾ ਜੀਵਨ ਜਿਹੜਾ ਹੈ ਉਹ ਸੰਭਵ ਹੈ ਉਸ ਨੂੰ ਇਹ ਕਰਨ ਲਈ ਹਲੇ ਕਾਫੀ ਸਮਾਂ ਲੱਗ ਸਕਦਾ ਹੈ ਹਜੇ ਉਸ ਦੀ ਇਹ ਖੋਜ ਚੱਲ ਰਹੀ ਹੈ ਕਿ ਸਾਡਾ ਜੀਵਨ ਚੰਦਰਮਾ ਅਤੇ ਸੂਰਜ ਉੱਤੇ ਹੈ ਉਸ ਨੇ ਹੁਣੇ ਇਸ ਚੀਜ਼ ਨੂੰ ਇਸ ਚੀਜ਼ ਦੀ ਖੋਜ ਕਾਰਨ ਖੋਜ ਕਰਨ ਲਈ ਚੰਦਰੀ ਸੂਰਜ ਦੀ ਖੋਜ ਕਰਨ ਲਈ ਉਸ ਨੇ ਚੰਦਰਯਾਨ ਥ੍ਰੀ ਵੀ ਭੇਜਿਆ ਸੀ ਅਤੇ ਇਸੇ ਤਰ੍ਹਾਂ ਉਹ ਹੋਰ ਹੋਰ ਵੀ ਬਹੁਤ ਸਾਰੀ ਕਾਢਾਂ ਕੱਢ ਰਿਹਾ ਹੈ ਜਿਵੇਂ ਕਿ ਹੁਣ ਹੀ ਉਸ ਨੇ ਗਗਨਯਾਨ ਵੀ ਭੇਜਿਆ ਹੈ ਉਹ ਆਪਣੀ ਲ ਲਾਈਫ ਅੰਤਰਿਕਸ਼ ਵਿੱਚ ਕਿਵੇਂ ਸੈੱਟ ਹੋ ਸਕਦੀ ਹੈ ਇਸ ਚੀਜ਼ ਦਾ ਜ਼ਿਕਰ ਵੀ ਜਲਦੀ ਹੀ ਕਰੇਗਾ ਅਤੇ ਉਹ ਇਸ ਦੇ ਹੌਲੀ ਹੌਲੀ ਪੜਾਵ ਪਾਰ ਕਰ ਰਿਹਾ ਹੈ ਧੰਨਵਾਦ